ਧਰਮ ਲੋਕਾਂ ਨੂੰ ਉਹਨਾਂ ਦੇ ਤਿੱਥ ਤਿਉਹਾਰ 'ਤੇ ਇਕੱਠਾ ਕਰਦਾ ਹੈ ਅਤੇ ਉਹਨਾਂ ਨੂੰ ਧਾਰਮਿਕ ਭਾਈਚਾਰੇ ਨਾਲ਼ ਜੋੜਦਾ ਹੈ ਅਤੇ ਜਿਵੇਂ ਕੀ ਸਿੱਖ ਧਰਮ ਵਿੱਚ ਵਿਸਾਖੀ ਦਾ ਤਿਉਹਾਰ ਹੈ ਜੋ ਕਿ ਤੇਰ੍ਹਾਂ ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਂ ਪਿਆਰਿਆਂ ਨੂੰ ਅੰਮ੍ਰਿਤ ਛਕਾ ਕੇ ਪੰਜ ਪਿਆਰੇ ਅਤੇ ਸਿੱਖੀ ਸਾਦੀ ਸੀ ਅਤੇ ਲੋਕਾਂ ਨੂੰ ਗੁਰੂ ਦੇ ਰਾਹ 'ਤੇ ਚੱਲਣ ਦਾ ਹੁਕਮ ਬਖਸ਼ਿਆ ਸੀ ਅਤੇ ਲੋਕ ਹੁਣ ਇਸ ਨੂੰ ਪੂਰੇ ਮਨੋ ਸ਼ਰਧਾ ਨਾਲ ਇਸ ਤਿਉਹਾਰ ਨੂੰ ਮਨਾਉਂਦੇ ਹਨ ਅਤੇ ਪੂਰੇ ਦਿਲੋਂ ਨਾਲ਼ ਸਭ ਕੁਝ ਕਰਕੇ ਲੰਗਰ ਦੀ ਸੇਵਾ ਸਭ ਕੁਝ ਕਰਦੇ ਹਨ ਅਤੇ ਖੁਸ਼ੀ ਨਾਲ਼ ਵਿਸਾਖੀ ਦੇ ਮੌਕੇ 'ਤੇ ਅਨੰਦਪੁਰ ਸਾਹਿਬ ਜਾਂਦੇ ਹਨ ਅਤੇ ਤਿੰਨ ਦਿਨ ਉਥੇ ਮੱਥਾ ਟੇਕ ਕੇ ਰਹਿੰਦੀ ਮੱਥਾ ਟੇਕਦੇ ਹਨ ਰਹਿੰਦੇ ਹਨ ਅਤੇ ਖੁਸ਼ੀ ਨਾਲ਼ ਉਥੋਂ ਦਰਸ਼ਨ ਕਰਕੇ ਵਾਪਸ ਆਉਂਦੇ ਹਨ